ਜਿਵੇਂ ਕਿ ਸਾਰੇ ਹੀ ਅੱਜ ਕੱਲ੍ਹ ਅੱਜ ਕੱਲ੍ਹ ਦੀ ਮਹਿੰਗਾਈ ਵਿੱਚ ਬੱਚਤ ਕਰਦੇ ਹਨ ਸਾਨੂੰ ਆਪਣੇ ਬੱਚਿਆਂ ਨੂੰ ਵੀ ਬੱਚਤ ਕਰਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ ਬੱਚਤ ਆ ਜਿਹੜੀ ਉਹ ਭਵਿੱਖ ਦੀ ਆ ਫਿਊਚਰ ਦੀ ਪਹਿਲੀ ਕਮਾਈ ਹੁੰਦੀ ਹੈ ਬੱਚਤ ਕਰਨ ਨਾਲ ਜਿਹੜਾ ਹੁੰਦਾ ਬੱਚਤ ਕੀਤੀ ਹੋਵੇਗੀ ਵਿਅਕਤੀ ਨੇ ਤਾਂ ਭਵਿੱਖ ਵਿੱਚ ਕੋਈ ਇਹੋ ਜਿਹਾ ਮੁਸ਼ਕਿਲ ਟਾਈਮ ਆਉਂਦਾ ਗਾ ਜਿਹਦੇ ਵਿੱਚ ਬੱਚਤ ਕੀਤਾ ਹੋਇਆ ਪੈਸਾ ਹੀ ਸਾਡੇ ਕੰਮ ਆਉਂਦਾ ਹੈ ਵ ਵੱਡੇ ਤਾਂ ਸਾਰੇ ਬੱਚਤ ਕਰਦੇ ਹੀ ਹਨ ਅਤੇ ਪਰ ਸਾਨੂੰ ਆਪਣੇ ਜਿਹੜੇ ਬੱਚੇ ਆ ਜਾਂ ਛੋਟੇ ਆ ਆਪਣਿਆਂ ਤੋਂ ਉਹਨਾਂ ਨੂੰ ਬੱਚਤ ਬਾਰੇ ਸਮਝਾਉਣਾ ਚਾਹੀਦਾ ਹੈ ਕਿ ਬੱਚਤ ਆ ਜਿਹੜੀ ਭਵਿੱਖ ਦੀ ਪਹਿਲੀ ਕਮਾਈ ਹੁੰਦੀ ਹੈ ਕਮਾਈ ਹੁੰਦੀ ਹੈ ਅਤੇ ਬੱਚਤ ਕਰਨੀ ਚਾਹੀਦੀ ਹੈ ਸਾਨੂੰ